ਸਾਡਾ ਵਿਆਹ ਤਾਂ ਜੀ ਇੱਕ ਮਹੀਨਾ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਗਾਣਾ ਵਜਾਉਣਾ ਰਾਤ ਨੂੰ ਸਾਰੇ ਆਉਂਦੇ ਐਂ ਔਰਤਾਂ ਨੂੰ ਤੀਵੀਂਆਂ ਨੂੰ ਬੁਲਾ ਬੁਲਾ ਕੇ ਵੀ ਰਾਤ ਨੂੰ ਮਨੋਰੰਜਨ ਕਰਦੇ ਹਾਂ ਗੀਤ ਗਾਉਂਦੇ ਹਾਂ ਹੈ ਨਾ ਫਿਰ ਸਾਰੇ ਰਿਸ਼ਤੇਦਾਰੀਆਂ ਨੂੰ ਕਾਰਡ ਪਹੁੰਚਾ ਕੇ ਫਿਰ ਉਹਨਾਂ ਨੂੰ ਉਨ੍ਹਾਂ ਘਰੇ ਜਾ ਕੇ ਮਿਲਕੇ ਫਿਰ ਸਾਰਿਆ ਨੂੰ ਕਾਰਡ ਵੰਡ ਕੇ ਫਿਰ ਮਿਠਾਈ ਦਾ ਡੱਬਾ ਦੇ ਕੇ ਵੀ ਨਿਮੰਤਰਨ ਦਿੱਤਾ ਜਾਂਦਾ ਵੀ ਤੁਸੀਂ ਸਾਡੇ ਘਰ ਆਇਓ ਫਿਰ ਜਾਗੋ ਰੱਖੀ ਜਾਂਦੀ ਹੈ ਫਿਰ ਵਿਆਹ ਫਿਰ ਪੈਲਿਸ ਵਗੈਰਾ ਬੁੱਕ ਕਰਕੇ ਵਿਆਹ ਕਰਦੇ ਹਾਂ ਸਾਡੇ ਰਸਮਾਂ ਬਹੁਤ ਵਧੀਆ ਹੈ ਬਹੁਤ ਬਹੁਤ ਮਤਲਬ ਕਿ ਬਹੁਤ ਮਜ਼ਾ ਜਿਹਾ ਆਉਂਦਾ ਵਿਆਹ ਵਿੱਚ ਸਾਡੇ